ਹੈਲੋ ਸਰ ਬਰਨਾਲਾ ਕਲੱਬ ਤੋਂ ਬੋਲ ਰਹੇ ਹਾਂ ਜੀ ਸਰ ਮੈਂ ਇਕ ਗੱਲ ਕਰਨੀ ਸੀ ਆਪਣੇ ਬੱਚਿਆਂ ਬਾਰੇ ਮੇਰੇ ਇੱਕ ਬੇਟੇ ਅਤੇ ਇੱਕ ਬੇਟੀ ਨੇਗੇ ਅਤੇ ਉਹ ਫੋਨ ਦਾ ਬਹੁਤ ਜ਼ਿਆਦਾ ਯੂਜ ਕਰਦੇ ਨੇਗੇ ਤਾਂ ਉਹਨਾਂ ਨੂੰ ਮੈਂ ਗੇਮ 'ਚ ਪਾਰਟੀਸਪੇਸਨ ਕਰਾਉਣੀ ਆ ਕਿ ਮੈਂ ਤੋਂ ਫੋਨ ਨਾ ਮਤਲਬ ਇੱਕ ਤਾਂ ਉਹਨਾਂ ਦੇ ਸਿਹਤ ਤੇ ਫੈਕਟ ਪੈਂਦਾ ਅਤੇ ਬਾਕੀ ਫਿਜੀਕਲ ਐਕਟੀਵਿਟੀ ਵੀ ਨਹੀਂ ਹੁੰਦੀ ਅਤੇ ਉਹਨਾਂ ਦੀ ਆਈ ਸਾਈਟ 'ਤੇ ਵੀ ਫ਼ਰਕ ਪੈਂਦਾ ਤੁਸੀਂ ਦੱਸ ਸਕਦੇ ਹੋ ਆਪਣੇ ਕਲੱਬ ਵਿੱਚ ਕਿਹੜੀਆਂ ਕਿਹੜੀਆਂ ਖੇਡਾਂ ਮੌਜੂਦ ਨੇ ਠੀਕ ਹੈ ਸਰ ਅਤੇ ਸਰ ਮਤਲਬ ਬੇਟੀ ਵਾਸਤੇ ਵੀ ਸਾਰੀ ਖੇਡਾਂ ਮਤਲਬ ਦੱਸ ਸਕਦੇ ਬੇਟੀ ਵਾਸਤੇ ਕਿਹੜੀ ਖੇਡਾਂ

ਅਤੇ ਸਰ ਫੀਲਡ ਗੇਮਸ ਵੀ ਨੇਗੀਆਂ ਫੀਲਡ ਮਤਲਬ ਜਿਵੇਂ ਹੋਕੀ ਕ੍ਰਿਕਟ ਵਗੈਰਾ ਫੁੱਟਬਾਲ ਐਨੀਥਿੰਗ ਮਤਲਬ ਇਨਇੰਡੋਰ ਨੇਂ ਗੀਆਂ ਠੀਕ ਹੈ ਸਰ ਅਤੇ ਸਰ ਮੈਂ ਅਤੇ ਕੀ ਪ੍ਰਾਈਜ ਵੀ ਚਲ ਦੋਵਾਂ ਦਾ ਕਿ ਸਰ ਵੰਨ ਦਾ ਠੀਕ ਹੈ ਸਰ ਅਤੇ ਟਾਈਮਿੰਗ ਕੀ ਆ ਸਰ ਮਤਲਵ ਬਾਰ੍ਹਾਂ ਘੰਟੇ ਸਰ ਤਾਂ ਸਰ ਮਤਲਬ ਬੱਚੇ ਦੇ ਕਿੰਨੇ ਘੰਟੇ ਲਗਵਾਉਂਦੇ ਹੋ ਸਰ ਵੈਸੇ

ਠੀਕ ਹੈ ਸਰ ਠੀਕ ਹੈ ਸਰ ਓਕੇ ਜੀ